ਜ਼ਿਆਦਾਤਰ ਜਿਹੜੇ ਝਗੜੇ ਹੁੰਦੇ ਹਨ ਉਹ ਆਪਸੀ ਮਤਭੇਦ ਜਾਂ ਕਿਸੇ ਅਣਕਹੀ ਗੱਲ ਦੇ ਕਾਰਨ ਹੁੰਦੇ ਹਨ ਜਿਸ ਨੂੰ ਵੱਡਿਆਂ ਦੇ ਵਿੱਚ ਬੈਠ ਕੇ ਆਰਾਮ ਦੇ ਨਾਲ ਦੋਨੋਂ ਪੱਖ ਰੱਖ ਕੇ ਆਪਣੇ ਆਪ ਸੁਲਝਾ ਸਕਦੇ ਹਨ ਪਿੰਡਾਂ ਵਿੱਚ ਜ਼ਿਆਦਾਤਰ ਦੇਖਿਆ ਗਿਆ ਹੈ ਕਿ ਬੜੇ ਬਜ਼ੁਰਗ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਲਈ ਦੋਹਾਂ ਧਿਰਾਂ ਨੂੰ ਇਕੱਲੇ ਇਕੱਲੇ ਬਿਠਾ ਕੇ ਅਤੇ ਉਹਨਾਂ ਤੋਂ ਆਪਣੀ ਆਪਣੀ ਗੱਲ ਦੱਸਦੇ ਹਨ ਜਦੋਂ ਦੋਨੋਂ ਪੱਖ ਸੁਣ ਕੇ ਬਜ਼ੁਰਗ ਆਪਣੇ ਆਪਸ ਵਿੱਚ ਸਲਾਹ ਕਰਕੇ ਬਾਹਰ ਆਉਂਦੇ ਹਨ ਅਤੇ ਉਹ ਦੋਨਾਂ ਪੱਖਾਂ ਦੇ ਵਿਚੋਲ ਵਿਚੋ ਵਿਚ ਵਿਚਦੇ ਰਾਹ ਨੂੰ ਫੜ੍ਹਦੇ ਹੋਏ ਦੋਹਾਂ ਧਿਰਾਂ ਦੇ ਸਿਰ ਇੱਕ ਪਾਸੇ ਕਰਕੇ ਅਤੇ ਸਲਾਹ ਦਿੰਦੇ ਹਨ ਜਿਹਨਾਂ ਦਾ ਸਲਾਹ ਮੰਨੀ ਉਹਨਾਂ ਲੋਕਾਂ ਦੇ ਹੱਕ 'ਤੇ ਹੁੰਦਾ ਹੈ ਕਈ ਤਾਂ ਦੇਖੇ ਹਨ ਪਰ ਹੁਣ ਇੰਨਾ ਯਾਦ ਨਹੀਂ ਆ ਰਿਹਾ ਕਿ ਕੋਈ ਸੀਨ ਇੱਦਾਂ ਦਾ ਧੰਨਵਾਦ